ਪੌਦੇ ਉਗਾਉਣ ਦੇ ਲਈ ਜਿਹੜੀ ਮਿੱਟੀ ਆ ਤਕਰੀਬਨ ਦੇਖੀਦੀ ਆ ਕਿ ਵਧੀਆ ਹੋਵੇ ਜਿੱਦਾਂ ਕਿ ਕਹਿ ਲਓ ਕਿ ਰੂੜੀ ਵਗੈਰਾ ਜਦੋਂ ਪਸ਼ੂਆਂ ਦਾ ਜਿਹੜਾ ਗੋਹਾ ਹੁੰਦਾ ਉਹ ਸੁੱਕ ਕੇ ਰੂੜੀ ਬਣ ਜਾਂਦੀ ਆ ਸੋ ਨਾਲ ਮਿੱਟੀ ਦੇ ਵਿੱਚ ਗੋਹਾ ਮਿਕਸ ਕਰ ਲਈਦਾ ਉਹਦੇ ਵਿੱਚ ਜਦ ਵੀ ਕੋਈ ਪੌਦਾ ਲਗਾਉਣਾ ਹੋਵੇ ਜਾਂ ਕੋਈ ਫਰੂਟ ਵਾਲਾ ਜਾਂ ਕੋਈ ਵੀ ਪੌਦਾ ਉਹ ਮਿਕਸ ਕਰਕੇ ਮਿੱਟੀ ਦੇ ਵਿੱਚ ਚੰਗੀ ਤਰ੍ਹਾਂ ਸੋ ਗੋਡੀ ਵਗੈਰਾ ਕਰਕੇ ਚੰਗੀ ਤਰ੍ਹਾਂ ਜਿਹੜੀ ਆ ਮਿੱਟੀ ਤਿਆਰ ਕਰਕੇ ਫਿਰ ਉਹਦੇ ਵਿੱਚ ਬੂਟਾ ਲਗਾ ਦਈਦਾ ਅਤੇ ਬੂਟਾ ਲਗਾਉਣ ਤੋਂ ਬਾਅਦ ਜਿਹੜੇ ਖਾਦ ਆ ਉਹ ਤਾਂ ਤਕਰੀਬਨ ਜ਼ਿਆਦਾਤਰ ਨਹੀਂ ਨਹੀਂ ਵਰਤਦੇ ਕਿਉਂਕਿ ਉਹ ਖਾਦ ਜਿਹੜੀ ਆ ਉਹ ਕੀਟਨਾਸ਼ਕ ਦਵਾਈਆਂ ਜਿਹੜੀਆਂ ਤਕਰੀਬਨ ਨਾ ਹੀ ਵਰਤੀਆਂ ਤਾਂ ਵਧੀਆ ਗੱਲ ਆ ਨਹੀ ਵਰਤੀ ਦੀਆਂ ਲਗਭਗ ਵਰਤੀ ਦੀਆਂ ਨਹੀ ਗੀਆਂ ਸੋ ਜਿਹੜੀ ਮਿੱਟੀ ਆ ਉਹਦੇ ਵਿੱਚ ਜ਼ਰੂਰ ਜਿਹੜਾ ਗੋਹਾ ਵਗੈਰਾ ਮਿਕਸ ਕਰ ਲਈਦਾ ਜਾਂ ਫਿਰ ਜਿਹੜੇ ਆ ਗੰਡੋਇਆਂ ਵਾਲੀ ਖਾਦ ਇੱਕ ਮਿਲਦੀ ਆ ਜਿਹਦੇ ਵਿੱਚ ਗੰਡੋਏ ਹੁੰਦੇ ਮਿੱਟੀ ਦੇ ਵਿੱਚ ਉਹ ਜਿਹੜੀ ਆ ਉਹ ਵੀ ਵਿੱਚ ਮਿਕਸ ਕਰ ਦਈਦੀ ਆ ਉਹਦੇ ਨਾਲ ਵੀ ਜਿਹੜੇ ਤੱਤ ਪੌਦੇ ਨੂੰ ਜਿਹੜੇ ਵਧੀਆ ਮਿਲ ਜਾਂਦੇ ਆ ਸੋ ਇਹੋ ਜਿਹੀ ਮਿੱਟੀ ਜਿਹੜੀ ਆ ਪੌਦੇ ਉਗਾਉਣ ਦੇ ਲਈ ਵਰਤਦੇ ਆ